ਸਤਿ ਸ਼੍ਰੀ ਅਕਾਲ ਜੀ ਉਸ ਤਰ੍ਹਾਂ ਤਾਂ ਪੰਜਾਬੀ ਦੇ ਵਿੱਚ ਬੜੇ ਹੀ ਜ਼ਿਆਦਾ ਸ਼ਬਦ ਅਤੇ ਵਾਕਾਂਸ਼ ਹਨ ਪਰ ਮੇਰੇ ਕੁਝ ਸ਼ਬਦ ਬਹੁਤ ਜ਼ਿਆਦਾ ਪਸੰਦੀਦਾਰ ਹਨ ਜਿਵੇਂ ਕਿ ਸਤਿ ਸ਼੍ਰੀ ਅਕਾਲ ਅਤੇ ਉਮੀਦ ਜਿੱਦਾਂ ਕਿ ਅਸੀਂ ਕਿਸੇ ਨੂੰ ਮਿਲਦੇ ਹਾਂ ਅਤੇ ਸਭ ਤੋਂ ਪਹਿਲਾ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਇਸ ਨਾਲ ਸਾਡਾ ਪ੍ਰਭਾਵ ਅਗਲੇ ਦੂਜੇ ਬੰਦੇ ਉੱਤੇ ਬੜਾ ਵਧੀਆ ਪੈਂਦਾ ਹੈ ਅਤੇ ਉਹ ਸਾਨੂੰ ਚੰਗਾ ਸਮਝਦਾ ਹੈ ਅਤੇ ਵਧੀਆ ਪੜ੍ਹਿਆ ਲਿਖਿਆ ਇਨਸਾਨ ਸਮਝਦਾ ਹੈ ਸਾਨੂੰ ਹਰੇਕ ਨੂੰ ਮਿਲ ਕੇ ਸਤਿ ਸ਼੍ਰੀ ਅਕਾਲ ਬੁਲਾਉਣੀ ਚਾਹੀਦੀ ਹੈ ਇਸ ਲਈ ਇਹ ਸ਼ਬਦ ਮੇਰਾ ਬਹੁਤ ਹੀ ਪਸੰਦੀਦਾਰ ਹੈ ਇੱਕ ਸ਼ਬਦ ਉਮੀਦ ਜਿੱਦਾਂ ਕਿ ਸਾਨੂੰ ਕਿਸੇ ਚੀਜ਼ ਦੀ ਉਮੀਦ ਹੁੰਦੀ ਹੈ ਅਤੇ ਉਹ ਚੀਜ਼ ਸਾਨੂੰ ਪ੍ਰਾਪਤ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਇਸ ਕਰਕੇ ਉਹ ਸ਼ਬਦ ਵੀ ਮੈਨੂੰ ਬੜਾ ਮਨ ਪਸੰਦ ਲੱਗਦਾ ਹੈ ਅਤੇ ਮੇਰਾ ਮਨ ਪਸੰਦੀਦਾਰ ਵਾਕਾਂਸ਼ ਇਹ ਹੈ ਕਿ ਜਿੱਦਾਂ ਮਨਿ ਜੀਤੈ ਜਗੁ ਜੀਤੁ ਭਾਵ ਜਿੱਦਾਂ ਜਦੋਂ ਅਸੀਂ ਆਪਣੇ ਮਨ ਨੂੰ ਜਿੱਤ ਲੈਂਦੇ ਹਾਂ ਤਾਂ ਅਸੀਂ ਜੱਗ ਨੂੰ ਜਿੱਤ ਲੈਂਦੇ ਹਾਂ ਜਿਵੇਂ ਕਿ ਮਨ ਉੱਤੇ ਕਾਬੂ ਪਾਉਣਾ ਬੜਾ ਹੀ ਔਖਾ ਹੈ ਜਿਹੜਾ ਮਨ ਉੱਤੇ ਕਾਬੂ ਪਾ ਲੈਂਦਾ ਹੈ ਉਹ ਸਾਰੇ ਜੱਗ ਨੂੰ ਜਿੱਤ ਲੈਂਦਾ ਹੈ ਇਸ ਕਰਕੇ ਇਹ ਵਾਕ ਵੀ ਮੈਨੂੰ ਬੜਾ ਚੰਗਾ ਲੱਗਦਾ ਹੈ ਧੰਨਵਾਦ